ਹਾਂਜੀ ਮੈਂ ਚੁਲ੍ਹੇ 'ਤੇ ਰੋਟੀ ਬਣਾਈ ਹੈ ਚੁਲ੍ਹੇ 'ਤੇ ਰੋਟੀ ਬਣਾਉਣਾ ਮੈਨੂੰ ਬਹੁਤ ਹੀ ਪਸੰਦ ਹੈ ਅਤੇ ਚੁਲ੍ਹੇ 'ਤੇ ਚੁਲ੍ਹੇ 'ਤੇ ਰੋਟੀ ਬਹੁਤ ਹੀ ਜ਼ਿਆਦਾ ਸੁਆਦ ਬਣਦੀ ਹੈ ਚੁਲ੍ਹੇ ਦੀ ਵਰਤੋਂ ਰੋ ਰੋਟੀ ਸਬਜ਼ੀ ਬਣਾਉਣ ਲਈ ਕਰਦੇ ਹਾਂ ਅਤੇ ਅਸੀਂ ਗੈਸ 'ਤੇ ਚਾਹ ਬਣਾਉਂਦੇ ਹਾਂ ਚਾਹ ਕੌਫੀ ਬਣਾਉਂਦੇ ਹਾਂ ਅਤੇ ਦੁੱਧ ਉਬਾਲਦੇ ਹਾਂ